ਹਾਂਜੀ ਸਬਜ਼ੀਆਂ ਲਈ ਦੀਦੀ ਇੱਕ ਤਾਂ ਹੈਗੀ ਹੈ ਉੱਥੇ ਹਾਂਜੀ ਸਬਜ਼ੀਆਂ ਵਾਸਤੇ ਇੱਕ ਅਤੇ ਆਪਣੇ ਆਪਣੇ ਜਿਹੜਾ ਫਾਟਕ ਬਣਾਇਆ ਹੋਇਆ ਫਾਟਕ ਮਤਲਬ ਕਾਫ਼ੀ ਰੇਹੜੀਆਂ ਲੱਗਦੀਆਂ ਉੱਥੇ ਫਰੈੱਸ਼ ਮਿਲਦੀ ਹੈ ਅਤੇ ਇੱਕ ਆਪਣੇ ਮਾਨਸਾ ਦੇ ਵਿੱਚ ਸਬਜ਼ੀ ਮੰਡੀ ਵੀ ਹੈਗੀ ਹੈ ਸਬਜ਼ੀ ਮੰਡੀ ਦੇ ਵਿੱਚ ਤਾਂ ਡੇਲੀ ਨਵੀਂ ਤੋਂ ਨਵੀਂ ਆਈਟਮ ਵੀ ਆਉਂਦੀਆਂ ਨਵੀਆਂ ਸਬਜ਼ੀਆਂ ਆਉਂਦੀਆਂ ਤਾਜ਼ੀਆਂ ਸਬਜ਼ੀਆਂ ਬਿਲਕੁਲ ਤਾਜ਼ੀਆਂ ਸਬਜ਼ੀਆਂ ਆਉਂਦੀਆਂ ਨੇ ਤੁਸੀਂ ਹਾਂਜੀ ਅਤੇ ਸੁਬਾਹ ਜਲਦੀ ਜਾ ਕੇ ਲਿਆ ਕਰੋ ਤਾਂ ਬੈਟਰ ਆ ਨਹੀਂ ਸ਼ਾਮ ਨੂੰ ਵੀ ਵਧੀਆ ਮਿਲ ਜਾਂਦੀਆਂ ਨੇ ਹਾਂਜੀ ਅਤੇ ਹੋਰ ਆਪਣੇ ਹਾਂਜੀ ਆਪਣੇ ਇੱਕ ਇੱਥੇ ਮਲੇਲੀਅਨ ਸਿਟੀ ਬਣੀ ਹੋਈ ਆ ਹਾਂਜੀ ਉੱਥੇ ਦੀਦੀ ਮੋਲ ਟਾਈਪ ਹੀ ਆ ਉਹਦੇ ਵਿੱਚ ਸਾਰਾ ਕੁਝ ਮਿਲ ਜਾਂਦਾ ਆਪਣੇ ਕੁਛ ਵੀ ਕੋਈ ਵੀ ਆਪਾਂ ਆਇਟਮ ਲੈਣੀ ਆ ਜਾਂ ਆਪਣੇ ਸਾਰਾ ਸਮਾਨ ਬੱਚਿਆਂ ਦਾ ਆਪਣਾ ਲੇਡੀਜ਼ ਦਾ ਜੈਂਟਸ ਗਾਰਮੈਂਟਸ ਲੇਡੀਜ਼ ਗਾਰਮੈਂਟਸ ਕੁਝ ਵੀ ਆਪਾਂ ਲੈਣਾ ਹੁੰਦਾ ਤਾਂ ਆਪਾਂ ਲੈ ਸਕਦੇ ਹਾਂ ਬੱਸ ਸਟੈਂਡ ਤੋਂ ਤਾਂ ਥੋੜ੍ਹਾ ਹੀ ਦੂਰ ਰਹਿ ਜਾਂਦਾ ਅਤੇ ਫਾਟਕਾਂ ਦੇ ਕੋਲ ਹਾਂਜੀ ਫਾਟਕ ਕੋਲ ਬਣਿਆ ਹੋਇਆ ਹੈਗਾ ਉੱਥੇ ਨਹੀਂ ਰੇਲ ਗੱਡੀ ਵਾਲੀ ਪਟੜੀ ਹੁੰਦੀ ਜਿਹੜੀ ਉੱਥੇ ਬਣਿਆ ਹੋਇਆ ਉੱਥੇ ਰਾ ਰੇਹੜੀਆਂ ਕਾਫ਼ੀ ਖੜ੍ਹੀਆਂ ਹੁੰਦੀਆਂ ਨੇ ਹਾਂਜੀ ਹਾਂਜੀ ਕੋਈ ਮਰਜ਼ੀ ਸਬਜ਼ੀ ਆਪਾਂ ਲੈ ਸਕਦੇ ਫਰੂਟ ਵੀ ਲੈ ਸਕਦੇ ਹਾਂ ਸਬਜ਼ੀ ਵੀ ਲੈ ਸਕਦੇ ਹਾਂ ਮਾਰਕਿਟ ਥੋੜ੍ਹਾ ਦੂਰ ਰਹਿ ਜਾਂਦੀ ਆ ਜੀ ਵੀ ਜਿੱਦਾਂ ਜ਼ਿਆਦਾ ਦੂਰ ਵੀ ਨਹੀਂ ਹੈਗਾ ਜੇ ਆਪਾਂ ਕਿਸੇ ਆਪਣੇ ਕਿਸੇ ਹੋਰ ਸਾਧਨ 'ਤੇ ਜਾਣਾ ਪਵੇ ਤਾਂ ਆਪਾਂ ਪੈਦਲ ਵੀ ਈਜੀਲੀ ਜਾ ਸਕਦੇ ਹਾਂ ਹਾਂਜੀ ਇੱਕ ਵਾਰੀ ਤੁਸੀਂ ਜ਼ਰੂਰ ਜਾ ਕੇ ਆਇਓ ਦੇਖ ਕੇ ਆਇਓ ਤੁਹਾਨੂੰ ਪਤਾ ਚੱਲੇਗਾ ਵੀ ਹਾਂ ਆਪਣੇ ਸਬਜ਼ੀ ਕਿੰਨੀਆਂ ਵੀ ਫਰੈਸ਼ ਹੁੰਦੀਆਂ ਵਧੀਆ ਹੁੰਦੀਆਂ ਨੇ ਅਤੇ ਰੇਟ ਵੀ ਕਾਫ਼ੀ ਘੱਟ ਹੁੰਦਾ ਇਵੇਂ ਆਮ ਹੋਰ ਸ਼ਹਿਰਾਂ ਨਾਲ਼ੋਂ ਹੋਰ ਸ ਮੰਡੀਆਂ ਨਾਲ਼ੋਂ ਰੇਟ ਦਾ ਵੀ ਕਾਫ਼ੀ ਫ਼ਰਕ ਹੈਗਾ

ਤੁਸੀਂ ਇੱਕ ਵਾਰੀ ਜਾਇਓ ਜ਼ਰੂਰ ਦੇਖਿਓ ਇਹ ਦੀਦੀ ਥੋੜ੍ਹਾ ਦੂਰ ਹੀ ਰਹਿ ਜਾਂਦੀ ਆ ਜਿਵੇਂ ਤੁਸੀਂ ਕਿਸੇ ਤੋਂ ਉੱਥੋਂ ਪੁੱਛ ਕੇ ਵੀ ਜਾ ਸਕਦੇ ਹੋ ਆਟੋ ਵਗੈਰਾ 'ਤੇ ਵੀ ਜਾ ਸਕਦੇ ਹੋ ਹਾਂਜੀ

ਹਾਂਜੀ ਹਾਂਜੀ ਓਕੇ ਜੀ ਹਾਂਜੀ ਹਾਂਜੀ ਓਕੇ